ਦੇਖੋ ਜੇ ਮੈਨੂੰ ਮੌਕਾ ਮਿਲੇ ਮੈਂ ਤਾਂ ਜੀ ਆਪਣੇ ਇਲਾਕੇ 'ਚ ਕਿਸਾਨਾਂ ਮਜ਼ਦੂਰਾਂ ਲਈ ਵੀ ਪਹਿਲੀ ਗੱਲ ਤਾਂ ਜੀ ਜੋ ਕਿ ਖੇਤੀਬਾੜੀ ਦੇ ਸੰਦ ਨੇ ਜੀ ਮੈਂ ਤਾਂ ਉਹੀ ਬਣਾਉਣ ਦੀ ਸਾਂਝੇ ਤੌਰ 'ਤੇ ਪ੍ਰੈਫਰੈਂਸ ਕਰੂੰਗਾ ਜੀ ਜਿਸ ਨਾਲ਼ ਕਿ ਸਾਰਿਆਂ ਨੂੰ ਸੌਖਾ ਰਹੂਗਾ ਵੀ ਸਾਰੇ ਜਣੇ ਉੱਥੇ ਆਉਣਗੇ ਅਤੇ ਆਪਣਾ ਪਾਉਣਗੇ ਅਤੇ ਆਪਣਾ ਕੰਮ ਕਰਨਗੇ ਜੀ ਧੰਨਵਾਦ ਜੀ